ਹੈਲੋ ਹੈਲੋ ਹਾਂ ਰਾਨੀ ਕੀ ਹਾਲ ਏ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਨੂੰ ਪੁੱਛਣਾ ਸੀ ਵੀ ਕੱਲ ਸਾਡੇ ਘਰੇ ਕੋਈ ਪ੍ਰੋਗਰਾਮ ਏ ਤੇ ਤੁਸੀਂ ਵੀ ਐਕਸਟਰਾ ਟਾਈਮ ਲਵਾ ਦਿਓਗੇ ਫਿਰ ਸਾਨੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਹਾਂਜੀ ਉਹਨਾਂ ਫਿਰ ਗੈਸਟ ਆਣੇ ਨੇ ਫਿਰ ਥੋੜਾ ਜਿਹਾ ਕੰਮ ਜਿਆਦਾ ਬਣ ਜਾਂਦਾ ਝਾੜੂ ਪੋਚਾ ਵਗੈਰਾ ਰੋਟੀ ਪਾਣੀ ਤੇ ਤੁਸੀਂ ਐਕਸਟਰਾ ਟਾਈਮ ਲਾ ਦੇਣਾ ਤੇ ਤੁਹਾਨੂੰ ਐਕਸਟਰਾ ਪੇਮੈਂਟ ਵੀ ਦੇ ਦਵਾਂਗੇ ਤੇ ਹਾਂਜੀ ਜਰੂਰੀ ਇਹ ਵੀ

ਹਾਂਜੀ ਹਾਂਜੀ ਹਾਂਜੀ

ਹਾਂਜੀ ਸਾਡਾ ਬਹੁਤ ਜਰੂਰੀ ਐ ਜੀ ਗੈਸਟ ਆ ਰਹੇ ਨੇ ਕੋਈ ਮੇਨ ਤੇ ਕਿਉਂਕਿ ਫਿਰ ਕੰਮ ਆਲੀ ਹੈਗੀ ਤਾਂ ਹੈਗੀ ਹੈ ਪਰ ਉਹ ਕੰਮ ਦੂਸਰਾ ਕਰਦੇ ਨੇ ਤੇ ਫਿਰ ਸਾਰਾ ਕੰਮ ਵੀ ਨਹੀਂ ਹੋਣਾ ਗਾ ਉਨਾਂ ਕੋਲੋ ਤੇ ਚਲੋ ਤੁਸੀਂ ਇਨਾ ਵੀ ਹੈਲਪ ਥੋੜੀ ਜਿਹੀ ਕਰ ਦੇਣਾ ਸਾਨੂੰ ਥੋੜਾ ਜਿਹਾ ਸੌਖਾ ਹੋ ਜਾਏਗਾ ਨਾਲ ਹਾਂਜੀ ਠੀਕ ਏ ਠੀਕ ਠੀਕ ਏ ਜੀ ਨੀ ਨੀ ਉਹ ਤਾਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਉਨੇ ਐਕਸਟਰਾ ਪੇਮੈਂਟ ਦੇ ਦਵਾਂਗੀ ਤੁਸੀਂ ਉਹਨਾਂ ਨੂੰ ਇੱਕ ਵਾਰੀ ਪੁੱਛ ਲੈਣਾ ਕਿ ਜੇ ਟਾਈਮ ਨਿਕਲਦਾ ਤਾ ਤੁਸੀਂ ਮੇਰੇ ਕੋਲ ਜਰੂਰ ਆ ਜਾਣਾ ਇੱਕ ਹੋਰ ਫਿਰ ਮੈਂ ਕਰ ਲਵਾਂਗੀ ਦੋ ਜਣੀਆਂ ਨਾਲ ਥੋੜੇ ਸੌਖਾ ਹੋ ਜਾਏਗਾ ਤੁਸੀਂ ਵੀ ਇਨੇ ਨਾਲ ਫਰੀ ਛੇਤੀ ਹੋ ਜਾਵੋਗੇ ਤੇ ਤੁਸੀਂ ਹਾਂ ਹਾਂਜੀ ਹਾਂਜੀ ਹਾਂਜੀ ਹਾਂ ਬਸ ਉਹਨਾ ਥੋੜਾ ਜਿਹਾ ਥੋੜਾ ਜਿਹਾ ਰਹਿ ਗਿਆ ਸੀ ਲਿਆਣ ਵਾਲਾ ਬਸ ਤੁਹਾਡੀ ਵੇਟ 'ਚ ਸੀਗੀ ਵੀ ਚਲੋ ਤੁਸੀਂ ਆ ਜਾਓਗੇ ਕੁਛ ਮੇਰੇ ਵੀ ਹੈਲਪ ਹੋ ਜਾਏਗੀ ਫਿਰ ਇਕੱਠੇ ਜਾ ਕੇ ਸਮਾਨ ਲੈ ਆਵਾਂਗੇ ਤੇ ਕੀ ਕੀ ਚਾਹੀਦਾ ਤੇ ਕੀ ਕੀ ਨਹੀਂ ਖਾਣਾ ਬਣਾਉਣਾ ਉਸ ਜਿਹੜੀ ਜਿਹੜੀ ਚੀਜ਼ ਲੈਣੀ ਉਹੀ ਚਲ ਲੈ ਆਵਾਂਗੇ ਹਾਂਜੀ ਹਾਂਜੀ ਸਾਡੇ ਘਰੇ ਫੰਕਸ਼ਨ ਛੋਟਾ ਜਿਹਾ ਸਾਡੇ ਬੇਟੇ ਦੀ ਹਾਂਜੀ ਅਗੇਜਮੈਂਟ ਹੈ ਤੇ ਇਸ ਕਰਕੇ ਮੈਂ ਹਾਂਜੀ ਕਹਿ ਰਹੀ ਸੀ ਤੇ ਉਹਨਾਂ ਨੇ ਸ਼ਗਨ ਲਾਣ ਵਾਸਤੇ ਆਣਾ ਸੀਗਾ ਤੇ ਤਾਂ ਕਰਕੇ ਵੀ ਮੈਂ ਤੁਹਾਨੂੰ ਕਹਿ ਰਹੀ ਸੀ ਵੀ ਚਲੋ ਆ ਜਾਣਾ ਮੇਰੀ ਥੋੜੀ ਜਿਹੀ ਹੈਲਪ ਹੋ ਜਾਏਗੀ

ਓਕੇ ਓਕੇ ਹਾਂਜੀ ਕਿਉਂਕਿ ਉਹਨਾਂ ਨੇ ਵੀ ਥੋੜਾ ਜਿਹਾ ਵੀ ਲੇਟ ਈ ਆਣਾ ਏ ਬਾਰਾਂ ਇੱਕ ਵੱਜ ਈ ਜਾਣਾ ਉਹਨਾਂ ਨੂੰ ਵੀ ਤੇ ਕੁਝ ਹਾਂਜੀ ਹਾਂਜੀ ਤੇ ਫਿਰ ਉਹਨਾ ਆਣਾ ਕਾਫੀ ਦੂਰੋਂ ਨੇ ਨਾ ਤਾਂ ਬਾਰਾਂ ਇਕ ਉਹਨਾਂ ਨੂੰ ਵੱਜ ਜਾਣਾ ਤੇ ਫਿਰ ਇਸੇ ਕਰਕੇ ਆਪਾਂ ਚਲੋ ਥੋੜੀ ਜੀ ਆਪਾਂ ਨੂੰ ਹੈਲਪ ਹੋ ਜਾਏਗੀ ਹਾਂਜੀ ਹਾਂਜੀ ਹਾਂਜੀ ਇਹ ਤਾਂ ਹੈਗਾ ਹੈ ਜੀ ਹਾਂਜੀ ਅੱਛਾ ਜੀ ਚਲੋ ਤੁਸੀਂ ਹਾਂਜੀ ਬਸ ਤੁਸੀਂ ਹਾਂਜੀ ਮੈਂ ਕਿ ਜੇ ਕੋਈ ਹੋਰ ਹੋਈ ਤੇ ਨਾਲ ਇੱਕ ਜਣੀ ਨੂੰ ਹੋਰ ਲੈ ਆਣਾ ਚਲੋ ਥੋੜਾ ਤੁਹਾਡਾ ਛੇਤੀ ਕੰਮ ਨਿਬੜ ਜਾਏਗਾ ਫਿਰ ਤੁਸੀਂ ਜਿੱਥੇ ਵੀ ਜਾਣਾ ਹੋਇਆ ਨਾ ਤੁਸੀਂ ਜਾ ਸਕਦੇ ਹਾਂਜੀ ਹਾਂਜੀ ਹਾਂਜੀ ਕਿਉਂਕਿ ਫਿਰ ਉਹਦੇ ਵਿੱਚ ਹਾਂਜੀ ਹਾਂਜੀ ਕਿਉਂਕਿ ਸਮਾਨ ਸਮੂਨ ਕਾਫੀ ਬਣਨਾ ਹ ਚਲੋ ਇੰਨੇ ਤੁਹਾਡੀ ਵੀ ਹੈਲਪ ਹੋ ਜਾਏਗੀ ਸਾਡੀ ਵੀ ਹੈਲਪ ਹੋ ਜਾਏਗੀ ਇੰਨੇ ਨਾਲ ਤੁਸੀਂ ਛੇਤੀ ਫਰੀ ਹੋ ਜਾਓਗੇ ਹਾਂਜੀ ਓਕੇ ਜੀ ਠੀਕ